ਹਾਂ ਜ਼ੁਕਾਮ ਦੇ ਘਰੇਲੂ ਕਈ ਇਲਾਜ ਹਨ ਜਿਵੇਂ ਕਿ ਜਦੋਂ ਆਪਾਂ ਚਾਹ ਬਣਾਉਂਦੇ ਹਾਂ ਉਸ ਵਿੱਚ ਲੋਂਗ ਪਾ ਸਕਦੇ ਹਾਂ ਅਦਰਕ ਪਾ ਸਕਦੇ ਹਾਂ ਇਸ ਦਾ ਚੰਗੀ ਤਰ੍ਹਾਂ ਮਿਸ਼ਰਣ ਜਦੋਂ ਪੂਰਾ ਬੋਆਏਲ ਹੋ ਜਾਂਦਾ ਏ ਉਸ ਨੂੰ ਪੀ ਕੇ ਆਪਾਂ ਰੈਸਟ ਕਰਾਂਗੇ ਰੈਸਟ ਕਰਨ ਦੇ ਨਾਲ ਜੇ ਆਪਾਂ ਨੂੰ ਫਰਕ ਪੈਂਦਾ ਤਾਂ ਵਧੀਆ ਏ ਜੇ ਨਹੀਂ ਫਰਕ ਪੈਂਦਾ ਤਾਂ ਇਸ ਵਿੱਚ ਆਪਾਂ ਪਾਣੀ ਨੂੰ ਸਟੀਮ ਕਰਕੇ ਉਸਦੀ ਸਟੀਮ ਵੀ ਲੈ ਸਕਦੇ ਹਾਂ ਸਟੀਮ ਨਾਲ ਕਾਫੀ ਹੱਦ ਤੱਕ ਚੰਗਾ ਅਸਰ ਦਿਖਾਉਂਦੀ ਹੈ ਜੇ ਇਸ ਤੋਂ ਬਾਅਦ ਵੀ ਆਪਾਂ ਨੂੰ ਕੋਈ ਚੰਗਾ ਰਿਜਲਟ ਨਹੀਂ ਮਿਲ ਰਿਹਾ ਹੈ ਤਾਂ ਫਿਰ ਆਪਾਂ ਇਸ ਤੋਂ ਉੱਪਰ ਜਾ ਕੇ ਅਤੇ ਡਾਕਟਰ ਸਾਹਿਬ ਦੀ ਰਾਏ ਦੇ ਮੁਤਾਬਿਕ ਦਵਾਈ ਲੈ ਸਕਦੇ ਹਾਂ ਤਾਂ ਇਸ ਤੋਂ ਆਪਾਂ ਜ਼ੁਕਾਮ ਤੋਂ ਨਿਜਾਤ ਪਾ ਸਕਦੇ ਹਾਂ